ਜਦੋਂ ਇਹ ਮੈਂ ਆਪਣੇ ਬਾਗ ਵਿੱਚ ਲਗਾਏ ਹੋਏ ਪੌਦਿਆਂ ਨੂੰ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਕੂਨ ਮਿਲਦੀ ਹੈ ਮਿਲਦਾ ਹੈ ਤਾਂ ਜਦ ਵੀ ਮੈਂ ਵਿਹਲਾ ਹੁੰਦਾ ਹਾਂ ਇਹਨਾਂ ਪੌਦਿਆਂ ਕੋਲ ਜਾ ਕੇ ਬੈਠ ਜਾਂਦਾ ਹਾਂ ਅਤੇ ਮੈਨੂੰ ਬਹੁਤ ਅਰਾਮ ਮਿਲਦਾ ਹੈ ਇਹਨਾਂ ਪੌਦਿਆਂ ਕੋਲ ਬੈਠ ਕੇ ਮੈਨੂੰ ਵਧੀਆ ਹਵਾ ਖਾਣ ਲਈ ਮਿਲਦੀ ਹੈ ਜਿਹਦੇ ਕਰਕੇ ਮੇਰੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਜਦ ਵੀ ਮੈਂ ਸਵੇਰੇ ਸ ਉੱਠਦਾ ਹਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦਿੰਦਾ ਹਾਂ ਜਿਸ ਕਾਰਨ ਮੈਨੂੰ ਬਹੁਤ ਸਕੂਨ ਮਿਲਦਾ ਹੈ ਜਦ ਵੀ ਮੈ ਮੇਰਾ ਫਰੀ ਟਾਈਮ ਹੁੰਦਾ ਹੈ ਮੈਂ ਪੁ ਮੈਂ ਪੌਦਿਆਂ ਨਾਲ ਟਾਈਮ ਸਪੈਂਡ ਕਰਨ ਜਾਂਦਾ ਹਾਂ ਅਤੇ ਇਹਨਾਂ ਨੂੰ ਤੱਕ ਕੇ ਮੇਰਾ ਮਨ ਵੀ ਖਿੜ ਜਾਂਦਾ ਹੈ ਜਦ ਵੀ ਮੈਨੂੰ ਕਸਰਤ ਕਰਨ ਦਾ ਮੂ ਮਨ ਹੁੰਦਾ ਹੈ ਤਾਂ ਮੈਂ ਆਪਣੇ ਬਾਗ ਦੇ ਵਿੱਚ ਹੀ ਕਸਰਤ ਕਰਦਾ ਹਾਂ ਅਤੇ ਇਹਨਾਂ ਪੌਦਿਆਂ ਨੂੰ ਤੱਕਦਾ ਰਹਿੰਦਾ ਹਾਂ ਅਤੇ ਇਹਨਾਂ ਪੌਦਿਆਂ ਨੂੰ ਖਿੜਦਿਆਂ ਦੇਖ ਮੈਨੂੰ ਹੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਜਦ ਵੀ ਮੇਰੇ ਘਰ ਦੇ ਵਿਹਲੇ ਹੁੰਦੇ ਹਨ ਉਹ ਵੀ ਇਸ ਪੌਦਿਆਂ ਨੂੰ ਵੇਖਣ ਲਈ ਆ ਜਾਂਦੇ ਹਨ